ਅਸੀਂ ਸਮਾਜ ਨੂੰ ਸਮਾਨਤਾ ਦੀ ਗੱਲਾਂ ਦੱਸਣਾ ਜਾਣ ਦੱਸਣਾ ਚਾਹੁੰਦੇ ਹਾਂ ਕਿ ਉਹ ਇੱਕ ਦੂਜੇ ਨਾਲ਼ ਹਮੇਸ਼ਾ ਮਿਲ ਕੇ ਰਹਿਣ